ਅਸੀਂ ਗਾਇਕੀ ਦੇ ਪ੍ਰਦਰਸ਼ਨ ਜਾਂ ਰਿਕਾਰਡਿੰਗ ਦੀ ਤਿਆਰੀ ਅਸੀਂ ਵੀਹ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਾਂ ਇਹ ਰੋਜ਼ ਇਸ 'ਤੇ ਰਿਆਜ਼ ਕੀਤਾ ਜਾਂਦਾ ਹੈ ਤਾਂ ਕਿ ਪ੍ਰਦਰਸ਼ਨ ਕਰਨ ਸਮੇਂ ਜਾਂ ਰਿਕਾਰਡਿੰਗ ਕਰਨ ਦੇਂਦੇ ਕਰਨ ਦੇ ਟਾਈਮ ਵਿੱਚ ਕੋਈ ਦਿੱਕਤ ਨਾ ਆਵੇ ਇਸ ਦਾ ਡੇਲੀ ਹੀ ਰਿਆਜ਼ ਕੀਤਾ ਜਾਂਦਾ ਹੈ ਇਸ ਨੂੰ ਜਦੋਂ ਫਿਰ ਅਸੀਂ ਪ੍ਰਦਰਸ਼ਨ ਕਰਨਾ ਹੁੰਦਾ ਹੈ ਤਾਂ ਉਹ ਆ ਇਸ ਤਾਂ ਅਸੀਂ ਇਹਨੂੰ ਕਿਸੇ ਫੋਨ ਜਾਂ ਕੈਮਰੇ ਵਿੱਚ ਰਿਕਾਰਡ ਕਰ ਕਰਕੇ ਦੇਖਦੇ ਹਾਂ ਫਿਰ ਇਸ ਨੂੰ ਅਸੀਂ ਅੱਗੇ ਅਪਲੋਡ ਕਰ ਦਿੰਦੇ ਹਾਂ ਜੇ ਸਾਨੂੰ ਚੰਗਾ ਲੱਗਦਾ ਹੈ ਤਾਂ ਇਸ ਤਰ੍ਹਾਂ ਹੀ ਅਸੀਂ ਗਾਇਕੀ ਅਤੇ ਰਿਕਾਰਡਿੰਗ ਦੀ ਪ੍ਰਦਰਸ਼ਨ ਦੀ ਅਸੀਂ ਤਿਆਰੀ ਕਰਦੇ ਹਾਂ